ਪੰਜਾਬ ਸਿੱਖ ਪਹਿਰਾਵੇ ਵਿੱਚ ਆਮ ਤੌਰ 'ਤੇ ਵਿਆਹ ਬਹੁਤ ਹੀ ਧੂਮਧਾਮ ਨਾਲ ਆਏ ਮਨਾਏ ਜਾਂਦੇ ਹਨ ਸਵੇਰੇ ਸਵੇਰੇ ਵਿਆਹ ਵਾਲੇ ਜੋੜੇ ਦੇ ਅਨੰਦ ਕਾਰਜ ਗੁਰੂ ਘਰ ਲਿਜਾ ਕੇ ਕੀਤੇ ਜਾਂਦੇ ਹਨ ਅਤੇ ਉੱਥੇ ਗੁਰੂ ਦੀ ਹਾਜ਼ਰੀ ਵਿੱਚ ਹੀ ਇੱਕ ਕੁੜੀ ਅਤੇ ਮੁੰਡੇ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹਿਆ ਜਾਂਦਾ ਹੈ ਅੱਜ ਕੱਲ੍ਹ ਦੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਨੰਦ ਅਨੰਦ ਕਾਰਜ ਦੇ ਬਾਅਦ ਪੈਲਸ ਵਿੱਚ ਬੜੀ ਧੂਮਧਾਮ ਨਾਲ ਖਾਣ ਪੀਣ ਅਤੇ ਨੱਚਣ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਦੁਆਰਾ ਸਲਾਮੀ ਪਾਈ ਜਾਂਦੀ ਹੈ ਫਿਰ ਸ਼ਾਮ ਨੂੰ ਬਹੁਤ ਹੀ ਰਸਮ ਰਿਵਾਜ ਨਾਲ ਕੁੜੀ ਨੂੰ ਵਿਦਾ ਕੀਤਾ ਜਾਂਦਾ ਹੈ ਅਤੇ ਕੁੜੀ ਨੂੰ ਤੋਰਨ ਸਮੇਂ ਹਰ ਕਿਸੇ ਦਾ ਮਨ ਔਖਾ ਹੋ ਜਾਂਦਾ ਹੈ ਸਿੱਖਾਂ ਦੇ ਵਿਆਹ ਵਿੱਚ ਅਨੰਦ ਕਾਰਜ ਜ਼ਿਆਦਾ ਮਹੱਤਵ ਮਹੱਤਵ ਰੱਖਦੇ ਹਨ